ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ

ਹਾਂਜੀ ਅਤੇ ਮੈਡਮ ਇੱਥੇ ਸਭ ਤੋਂ ਵਧੀਆ ਬੇਕਰੀ ਪਠਾਨਕੋਟ ਦੀ ਹਿਮਾਲਿਆ ਬੇਕਰੀ ਆ ਮੈਮ ਇੱਥੇ ਸਾਰਾ ਕੁਛ ਵਧੀਆ ਮਿਲਦਾ ਵਾ ਹਾਂ ਮੈਮ ਨੋਰਮਲ ਰੇਟ 'ਤੇ ਮਿਲ ਜਾਂਦਾ ਵਾ ਹਾਂਜੀ ਮੈਮ ਫਰੈਸ਼ ਸਮਾਨ ਮਿਲਦਾ ਇੱਥੇ ਮੈਮ ਸਾਢੇ ਨੌਂ ਤੋਂ ਲੈ ਕੇ ਅਤੇ ਸਾਢੇ ਦਸ ਤੱਕ ਖੁੱਲ੍ਹੀ ਰਹਿੰਦੀ ਬੇਕਰੀ ਹਾਂਜੀ ਤੇ ਠੀਕ ਥੈਂਕਯੂ